ਹੈਲੋ ਗੁੱਡ ਮੋਰਨਿੰਗ ਸਰ ਤੁਸੀਂ ਏਮਰ ਰੈਸਟੋਰੈਂਟ ਵਿੱਚੋਂ ਬੋਲ ਰਹੇ ਹੋ ਹਾਂਜੀ ਸਰ ਸਰ ਮੈਂ ਨਮਨ ਜਿੰਦਲ ਭਿੱਖੀ ਤੋਂ ਬੋਲ ਰਿਹਾ ਸੀਗਾ ਹਾਂਜੀ ਸਰ ਸਰ ਮੈਨੇ ਨਾ ਸਮਾਨ ਦਾ ਆਰਡਰ ਦਿੱਤਾ ਸੀਗਾ ਅਤੇ ਮੈਨੇ ਪਤਾ ਕਰਨਾ ਸੀਗਾ ਵੀ ਉਹ ਸਮਾਨ ਕਦੋਂ ਤੱਕ ਪਹੁੰਚੂਗਾ ਸਰ ਸਮਾਨ ਦੇ ਵਿੱਚ ਦਸ ਪੀਸ ਪੀਜ਼ੇ ਦੇ ਸੀਗੇ ਦਸ ਬੋਤਲਾਂ ਠੰਡੇ ਦੀਆਂ ਨੇਗੀਆਂ ਅਤੇ ਦਸ ਬਰਗਰ ਨੇਗੇ ਹਾਂਜੀ ਸਰ ਮੈਂ ਜਾਣ ਸਕਦਾ ਹਾਂ ਵੀ ਤੁਸੀਂ ਇਹ ਸਮਾਨ ਕਦੋਂ ਤੱਕ ਡਿਲੀਵਰ ਕਰ ਦੋਂਗੇ ਅੱਛਾ ਸਰ ਇਹ ਤਾਂ ਬਹੁਤ ਜ਼ਿਆਦਾ ਲੇਟ ਹੋਜੂਗਾ ਸਰ ਜਦੋਂ ਮੈਨੇ ਪਹਿਲਾਂ ਤੁਹਾਨੂੰ ਕਾਲ ਕੀਤੀ ਸੀਗੀ ਉਦੋਂ ਤਾਂ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਦੋ ਘੰਟੇ ਬਾਅਦ ਤੁਹਾਡੇ ਕੋਲ ਸਮਾਨ ਪਹੁੰਚ ਜੂਗਾ ਤੁਹਾਡੇ ਪਤੇ 'ਤੇ ਪਰ ਹਜੇ ਤੱਕ ਸਰ ਕੋਈ ਸਮਾਨ ਨਹੀਂ ਆਇਆ ਹੈਗਾ ਹਾਂਜੀ ਸਰ ਸਰ ਐਕਚੁਲ ਨਾ ਸਾਡੇ ਘਰ ਇੱਕ ਛੋਟੀ ਜਿਹੀ ਅਸੀਂ ਨੇ ਪਾਰਟੀ ਰੱਖੀ ਸੀਗੀ ਪਾਰਟੀ ਦੇ ਵਿੱਚ ਸਰ ਮੈਨੇ ਆਪਣੇ ਫਰੈਂਡਸ ਨੂੰ ਬੁਲਾਇਆ ਸੀਗਾ ਰਿਲੇਟਿਵਸ ਨੂੰ ਬੁਲਾਇਆ ਸੀਗਾ ਹਾਂਜੀ ਸਰ ਹਾਂਜੀ ਸਰ ਸਰ ਤੁਹਾਨੂੰ ਪਤਾ ਵੀ ਗਰਮੀ ਦਾ ਟਾਈਮ ਹੈਗਾ ਵੀ ਕੀ ਕਹਿੰਦੇ ਨੇ ਅਸੀਂ ਤੁਹਾਨੂੰ ਦੋ ਘੰਟੇ ਪਹਿਲਾਂ ਹੀ ਆਰਡਰ ਦੇ ਦਿੱਤਾ ਸੀਗਾ ਵੀ ਇੰਨਾ ਟਾਈਮ ਹੋ ਚੁੱਕਿਆ ਹੈਗਾ ਹਜੇ ਤੱਕ ਸੋਨੇ ਸਾਨੂੰ ਆਰਡਰ ਦਿੱਤਾ ਨਹੀਂ ਹੈਗਾ ਹਾਂਜੀ ਸਰ ਹਾਂਜੀ ਸਰ ਜਲਦੀ ਨਹੀਂ ਹੋ ਸਕਦਾ ਇਸ ਤੋਂ ਸਰ ਫਿਰ ਤਾਂ ਚਲੋ ਰਹਿਣ ਦਿਓ ਕਿਉਂਕਿ ਮੈਨੇ ਤਾਂ ਸਰ ਤੁਹਾਨੂੰ ਦਿਓ ਘੰਟੇ ਪਹਿਲਾਂ ਹੀ ਆਰਡਰ ਦੇ ਦਿੱਤਾ ਸੀਗਾ ਹੁਣ ਤੁਸੀਂ ਕਹਿ ਰਹੇ ਹੋਗੇ ਵੀ ਦੋ ਘੰਟੇ ਹੋਰ ਲੱਗਣਗੇ ਸਰ ਬਹੁਤ ਜ਼ਿਆਦਾ ਟਾਈਮ ਹੋ ਜੂਗਾ ਸਰ ਮਜਬੂਰਨ ਫਿਰ ਮੈਨੂੰ ਤੁਹਾਡੀ ਕੰਪਲੇਂਟ ਤੁਹਾਡੇ ਮੈਨੇਜਰ ਨੂੰ ਕਰਨੀ ਪਊਗੀ ਸਰ ਸੋਰੀ ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਤਾਂ ਕੋਈ ਦਿੱਕਤ ਨਹੀਂ ਹੈਗੀ ਚੱਲੋ ਸਰ ਫਿਰ ਕੋਈ ਗੱਲ ਨਹੀਂ ਹੈਗੀ ਓਕੇ ਸਰ ਓਕੇ ਥੈਂਕ ਯੂ ਸਰ ਓਕੇ